ਹਾਂ ਤਸਵੀਰਾਂ ਤਸਵੀਰਾਂ ਜਿਵੇਂ ਕਿ ਪਹਾੜੀ ਏਰੀਏ ਦਾ ਦ੍ਰਿਸ਼ ਜਿਹੜਾ ਸਭ ਤੋਂ ਵਧੀਆ ਮੰਨਿਆ ਜਾਂਦਾ ਅਸੀਂ ਹਿਮਾਚਲ ਦੀ ਸਾਈਡ ਘੁੰਮਣ ਜਾਂਦੇ ਜਦੋਂ ਅਤੇ ਮੈਂ ਅੱਗੇ ਵੀ ਕਈ ਵਾਰੀ ਹਿਮਾਚਲ ਦੀ ਸਾਈਡ ਘੁੰਮਣ ਗਿਆ ਹੋਇਆ ਗਾ ਸ਼ਿਮਲਾ ਧਰਮਸ਼ਾਲਾ ਮਗਲੋੜਗੰਜ ਇਸ ਸਾਈਡ 'ਤੇ ਜਾਣੀ ਕਿ ਮਗਲੋੜਗੰਜ ਲਾ ਲਉ ਉੱਥੇ ਗਰਮੀਆਂ ਦੇ ਟਾਈਮ 'ਚ ਝਰਨੇ ਤਾਂ ਹਰ ਟਾਈਮ ਵੀ ਪੈਂਦੇ ਜਦੋਂ ਗਰਮੀਆਂ ਦੇ ਟਾਈਮ ਝਰਨੇ ਪੈਂਦੇ ਨੇ ਉੱਪਰੋਂ ਥੱਲੇ ਨੀਚੇ ਨੂੰ ਪਾਣੀ ਦੇ ਤਾਂ ਉੱਥੇ ਜਿਹੜਾ ਫੋਟੋਆਂ ਅਸੀਂ ਖਿੱਚੀਆਂ ਤਾਂ ਉਹਨਾਂ ਦਾ ਦ੍ਰਿਸ਼ ਬਹੁਤ ਹੀ ਖੂਬ ਬਹੁਤ ਹੀ ਵਧੀਆ ਮੰਨਿਆ ਗਿਆ ਅਤੇ ਬਹੁਤ ਹੀ ਖੂਬ ਮੰਨਿਆ ਮੰਨਿਆ ਕੀ ਗਿਆ ਦੇਖਣ ਨੂੰ ਬਹੁਤ ਵਧੀਆ ਮਿਲਿਆ ਬਹੁਤ ਸੋਹਣਾ ਦ੍ਰਿਸ਼ ਬਹੁਤ ਸੋਹਣੀਆਂ ਫੋਟੋਆਂ ਆਈਆਂ ਅਸੀਂ ਫੈਮਿਲੀ ਦੇ ਨਾਲ ਪੂਰੀ ਦੇ ਨਾਲ ਟੂਰ ਕੱਢਿਆ ਅਤੇ ਉਸ ਤੋਂ ਬਾਅਦ ਯਾਨੀ ਕਿ ਉੱਥੇ ਹੋਰ ਵੀ ਪਹਾੜੀ ਏਰੀਏ ਦੇ ਵਿੱਚ ਕਾਫੀ ਦ੍ਰਿਸ਼ ਵਧੀਆ ਸੀਗੇ ਹੈ ਨਾ ਹਰੇ ਹਰੇ ਭਰੇ ਦ੍ਰਿਸ਼ ਸੀਗੇ ਜਿਨ੍ਹਾਂ ਦੀ ਫੋਟੋਆਂ ਬਹੁਤ ਵਧੀਆ ਆਈਆਂ ਦੇਖਣ ਨੂੰ ਵੀ ਸੋਹਣੀਆਂ ਲੱਗ ਰਹੀਆਂ ਸੀ ਅਤੇ ਬਹੁਤ ਘੈਂਟ ਜਿਹੜੇ ਸੀਗੇ ਪੋਜ਼ ਵੀ ਬਹੁਤ ਘੈਂਟ ਬਣੇ ਅਤੇ ਉਸ ਤੋਂ ਬਾਅਦ ਅਸੀਂ ਜਿਵੇਂ ਕਿ ਸੁਖਨਾ ਲੇਕ ਚੰਡੀਗੜ੍ਹ ਆ ਗਏ ਚੰਡੀਗੜ੍ਹ 'ਤੇ ਵੀ ਸੁਖਨਾ ਲੇਕ 'ਤੇ ਫੋਟੋਆਂ ਕਲਿੱਕ ਕਰੀਆਂ ਉਹ ਵੀ ਫੋਟੋਆਂ ਬਹੁਤ ਸੋਹਣੀਆਂ ਆਈਆਂ ਅਤੇ ਬਹੁਤ ਹੀ ਵਧੀਆ ਦ੍ਰਿਸ਼ ਸੀਗੇ ਹੈ ਨਾ ਇਸ ਤੋਂ ਬਾਅਦ ਆਗਰਾ ਤਾਜ ਮਹਿਲ ਦੀਆਂ ਫੋਟੋਆਂ ਜਿਹੜੀਆਂ ਕਿ ਉੱਥੇ ਵੀ ਬਹੁਤ ਵਧੀਆ ਦ੍ਰਿਸ਼ ਬਣਦਾ ਤਾਜ ਤਾਜ ਮਹਿਲ 'ਤੇ ਫੋਟੋਆਂ ਬਹੁਤ ਸੋਹਣੀ ਫੋਟੋ ਆਉਂਦੀ ਹੈ ਬਹੁਤ ਸੋਹਣਾ ਵਧੀਆ ਪਿੱਛੋਂ ਦ੍ਰਿਸ਼ ਵਿਊ ਬਹੁਤ ਵਧੀਆ ਆਉਂਦਾ ਹੈਗਾ ਹੈ ਨਾ ਅਤੇ ਇਸ ਤਰ੍ਹਾਂ ਨਾਲ ਬਹੁਤ ਹੋਰ ਵੀ ਕਈ ਥਾਵਾਂ 'ਤੇ ਪਹਾੜੀ ਏਰੀਏ ਦੇ ਵਿੱਚ ਫੋਟੋਆਂ ਕਰੀਆਂ ਜਿਨ੍ਹਾਂ ਨਾਲ ਕਿ ਬਹੁਤ ਵਧੀਆ ਵਿਊ ਦ੍ਰਿਸ਼ ਬਣੇ ਬਹੁਤ ਸੋਹਣੀਆਂ ਫੋਟੋਆਂ ਆਈਆਂ ਅਤੇ ਹੁਣ ਮੈਂ ਇੱਕ ਕਿਤੇ ਫੋਰਨ ਦਾ ਟੂਰ ਠੀਕ ਹੈ ਨਾ ਵੇਖਣਾ ਚਾਹੁੰਦਾ ਵੀ ਕਿਤੇ ਬਾਹਰਲਾ ਕੋਈ ਕੰਟਰੀ ਹੋਵੇ ਉੱਥੇ ਬੀਚ 'ਤੇ ਫੋਟੋਆਂ ਕਰੀਆਂ ਜਾਣ ਤਾਂ ਉਹ ਮੈਨੂੰ ਬਹੁਤ ਪਸੰਦ ਹੈ ਅਤੇ ਜਾਂ ਫਿਰ ਗੋਆ ਗੋਆ ਬੀਚ ਜੇ ਬਾਹਰ ਦਾ ਨਹੀਂ ਹੋ ਸਕਦਾ ਤਾਂ ਗੋਆ ਬੀਚ ਜਾਂ ਮੁੰਬਈ ਦੇ ਵਿੱਚ ਮੁੰਬਈ ਬੀਚ ਇਸ ਤਰ੍ਹਾਂ ਕੋਈ ਕਿਸੇ ਵੀ ਜਾਣੀ ਕਿ ਆਪਣੇ ਫੋਰਨ ਕੰਟਰੀ ਜਾਂ ਆਪਣੇ ਇੱਧਰਲੀ ਕਿਸੇ ਵੀ ਸਟੇਟ ਦੀ ਬੀਚ ਜਿਹੜੀ ਮੈਨੂੰ ਕਿਤੇ ਜਾਣ ਦਾ ਮੌਕਾ ਮਿਲਦਾ ਮੈਂ ਜ਼ਰੂਰ ਉੱਥੇ ਜਾ ਕੇ ਅਤੇ ਆਪਣੀਆਂ ਫੋਟੋਆਂ ਕਲਿੱਕ ਕਰਾਂਗਾ ਅਤੇ ਇਸ ਮੈਨੂੰ ਫੋਟੋਆਂ ਬੀਚ 'ਤੇ ਜਾ ਕੇ ਜਾਂ ਇਸ ਤਰ੍ਹਾਂ ਦੇ ਫੋਰਨ ਕੰਟਰੀ ਦੇ ਵਿੱਚ ਕਿਤੇ ਵੀ ਜਾ ਕੇ ਫੋਟੋਆਂ ਕਲਿੱਕ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ ਅਤੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਜਾਵਾਂਗਾ